ਪਠਾਨਕੋਟ ਦੇ ਵਿੱਚ ਬਜ਼ੁਰਗਾਂ ਦੀ ਕੋਈ ਸਿਹਤ ਦਾ ਖਿਆਲ ਕੋਈ ਨਹੀਂ ਰੱਖਦਾ ਕੋਈ ਸਰਕਾਰ ਨੂੰ ਕੁਛ ਤੇ ਕੁਛ ਹੀ ਕਰਨਾ ਚਾਹੀਦਾ

ਪੈ ਆਹੋ ਪੈਨਸ਼ਨ ਲਗਾਉਣੀ ਚਾਹੀਦੀ ਹੈ ਬੁਢਾਪਾ ਪੈਨਸ਼ਨ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਕੋਈ ਕੰਮ ਨਹੀਂ ਹੁੰਦਾ ਕੋਈ ਕੁਛ ਨਹੀਂ ਹੁੰਦਾ ਪੈਨਸ਼ਨ ਦੀ ਜ਼ਰੂਰੀ ਹੈ ਸੇਵਾ ਕਰਨੀ ਚਾਹੀਦੀ ਹੈ